ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹੈਗਾ ਜੀ ਹਾਂਜੀ ਹਾਂਜੀ ਪਾਲ ਢਾਬੇ ਅਸੀਂ ਖਾਦੇ ਰਹਿੰਦੇ ਹਾਂ ਜੀ ਇਹ ਤਾਂ ਬਹੁਤ ਵਧੀਆ ਢਾਬਾ ਹੈ ਜੀ ਮਤਲਬ ਬਹੁਤ ਹੀ ਜ਼ਿਆਦਾ ਖਾਣ ਦੀਆਂ ਬਹੁਤ ਵਧੀਆ ਵਧੀਆ ਵੈਰਾਈਟੀਆਂ ਨੇ ਅਤੇ ਇਹਨਾਂ ਦਾ ਮਤਲਬ ਔਰਡਰ ਬਹੁਤ ਛੇਤੀ ਵਧੀਆ ਬਣਾਉਂਦੇ ਨੇ ਪਿਓਰ ਵੈੱਜ ਮਤਲਬ ਬਹੁਤ ਹੀ ਜ਼ਿਆਦਾ ਵਧੀਆ ਜੀ ਹਾਂਜੀ ਹਾਂਜੀ ਇੱਥੇ ਨਹੀਂ ਨਹੀਂ ਨਹੀਂ ਹਾਂਜੀ ਹਾਂਜੀ ਗਰਮੀ ਕੋਈ ਨਹੀਂ ਏ ਸੀ ਲੱਗੇ ਹੋਏ ਹੈਂ ਜੀ ਤੁਹਾਨੂੰ ਸਾਰੀ ਚੀਜ਼ਾਂ ਖਾਣ ਲਈ ਮਿਲੇਗੀ ਜੀ ਸ਼ਾਹੀ ਪਨੀਰ ਦਾਲ ਮੱਖਣੀ ਰਾਇਤਾ ਮਿਕਸ ਸਭ ਕੁਛ ਮਤਲਬ ਜੋ ਜੋ ਤੁਸੀਂ ਬੋਲੋਂਗੇ ਉੱਥੇ ਉਹ ਖਾਣ ਲਈ ਮਿਲੇਗਾ ਵਧੀਆ ਕੋਈ ਚੱਕਰ ਨਹੀਂ ਠੀਕ ਹੈ ਜੀ